ਮੈਂ ਉਸ ਵਿਅਕਤੀ ਨੂੰ ਇਹ ਸਲਾਹ ਦਵਾਂਗੀ ਕਿ ਭੰਗੜੇ ਨਾਲ ਸਾਡੇ ਸਰੀਰ ਦੀ ਕਸਰਤ ਹੁੰਦੀ ਹੈ ਭੰਗੜਾ ਸਾਡੇ ਸਰੀਰ ਲਈ ਬਹੁਤ ਵਧੀਆ ਹੁੰਦਾ ਹੈ ਭੰਗੜੇ ਨਾਲ ਸਾਡੇ ਸਰੀਰ ਦੀ ਐਕਸਰਸਾਈਜ਼ ਹੁੰਦੀ ਹੈ ਭੰਗੜਾ ਅਸੀਂ ਡੇਲੀ ਡੇਲੀ ਕਰਾਂਗੇ ਤਾਂ ਥੱਕ ਜਾਵਾਂਗੇ ਕਿਉਂਕਿ ਇਸ ਨਾਲ ਸਾਡਾ ਅੰਗ ਅੰਗ ਹਿਲਦਾ ਹੈ ਭੰਗੜੇ ਨਾਲ ਸਾਡਾ ਸਰੀਰ ਮੰਨ ਖੁਸ਼ਹਾਲ ਰਹਿੰਦਾ ਹੈ ਜਦੋਂ ਸਾਨੂੰ ਖੁਸ਼ੀ ਹੁੰਦੀ ਹੈ ਤਾਂ ਆਪਾਂ ਭੰਗੜਾ ਪਾਉਂਦੇ ਹਾਂ ਜਦੋਂ ਅੱਜ ਕੱਲ੍ਹ ਕਿਸੇ ਵੀ ਵਿਆਹ ਫੰਕਸ਼ਨ 'ਤੇ ਭੰਗੜੇ ਨੂੰ ਹੀ ਅਹਿਮੀਅਤ ਦਿੱਤੀ ਜਾਂਦੀ ਹੈ ਇਸ ਲਈ ਸਾਨੂੰ ਹਰ ਰੋਜ਼ ਭੰਗੜਾ ਕਰਨਾ ਚਾਹੀਦਾ ਹੈ ਮੈਂ ਹਰ ਰੋਜ਼ ਭੰਗੜਾ ਕਰਦੀ ਹਾਂ ਇਸ ਨਾਲ ਮੇਰਾ ਸਰੀਰ ਤੰਦਰੁਸਤ ਰਹਿੰਦਾ ਹੈ ਹੁਣ ਮੈਨੂੰ ਇਸ ਦੀ ਆਦਤ ਪੈ ਚੁੱਕੀ ਹੈ ਅਗਰ ਇਕ ਦਿਨ ਨਹੀਂ ਕਰਦੀ ਤਾਂ ਮੇਰਾ ਸਰੀਰ ਥਕਾਨ ਮਹਿਸੂਸ ਕਰਦਾ ਹੈ ਇਸ ਲਈ ਸਾਨੂੰ ਹਰ ਰੋਜ਼ ਭੰਗੜਾ ਜ਼ਰੂਰ ਕਰਨਾ ਚਾਹੀਦਾ ਹੈ